ਮੋਹਾਲੀ ਜ਼ਿਲ੍ਹੇ ਵਿੱਚ ਐਸੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਡੇਲੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟ੍ਰੈਫਿਕ ਬਹੁਤ ਹੁੰਦੀ ਹੈ ਜਿਹਦੇ ਕਰਕੇ ਘੰਟਾ ਘੰਟਾ ਧੁੱਪਾਂ ਵਿੱਚ ਖੜਕੇ ਵੇਟ ਕਰਨੀ ਪੈਂਦੀ ਹੈ ਅਤੇ ਮੌਜੂਦਾ ਸਰਕਾਰ ਇਸਦੇ ਲਈ ਕੋਈ ਸਖਤ ਕਦਮ ਨਹੀਂ ਚੁੱਕ ਰਹੀ ਜਿਸ ਕਾਰਨ ਬਹੁਤ ਸਾਰੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਜਿਵੇਂ ਕੀ ਜ਼ਿਆਦਾ ਗਰਮੀ ਕਾਰਨ ਉਹ ਡੇਲੀ ਬੁਖਾਰ ਦਾ ਸਾਹਮਣਾ ਕਰਦੇ ਹਨ ਅਤੇ ਬੋ ਜਿਹੜੇ ਬਹੁਤ ਸਾਰੇ ਪੰਛੀ ਹਨ ਉਹ ਮੋਹਾਲੀ ਜ਼ਿਲ੍ਹੇ ਵਿੱਚ ਘੱਟਦੇ ਜਾਂਦੇ ਹਨ ਕਿਉਂਕੀ ਇੱਥੇ ਟਾਵਰ ਬਹੁਤ ਲੱਗ ਗਏ ਹਨ ਜਿਹਦੇ ਕਾਰਨ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਜ਼ਿਲ੍ਹੇ ਵਿੱਚ ਜ਼ਿਆਦਾ ਪਿੰਡ ਹਨ ਜਿਨ੍ਹਾਂ ਵਿੱਚ ਕੋਈ ਵਧੀਆ ਜਿੰਮ ਔਰ ਫਿਟਨੈਸ ਸੈਂਟਰ ਨਹੀਂ ਹੈ ਜਿਹਦੇ ਕਾਰਨ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹਨ